ਹੋਰ ਸੱਭਿਆਚਾਰ ਅਤੇ ਨਾਚ ਦੇ ਰੂਪਾਂ ਦੇ ਐਕਸਪੋਜਰ ਵੱਧ ਰਹੇ ਹਨ ਅਤੇ ਸਾਡੇ ਪਿੰਡ ਦੇ ਵਿੱਚ ਨਾਚਾਂ ਦੇ ਤਰੀਕੇ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਪਹਿਲਾਂ ਤਾਂ ਜੋ ਪਹਿਲਾਂ ਤਾਂ ਜੋ ਪਿੰਡਾਂ ਵਿੱਚ ਤੀਆਂ ਲੱਗਦੀਆਂ ਸਨ ਉਹ ਪੰਦਰਾਂ ਦਿਨ ਪਹਿਲਾਂ ਹੀ ਤੀਆਂ ਲੱਗ ਜਾਂਦੀਆਂ ਸਨ ਪੰਦਰਾਂ ਦਿਨ ਹੀ ਕੁੜੀਆਂ ਇਕੱਠੀਆਂ ਹੋ ਕੇ ਆਪਣੇ ਸਹੁਰੇ ਸਹੁਰੇ ਘਰੋਂ ਆ ਕੇ ਪੇਕੇ ਘਰ ਵਿੱਚ ਤੀਆਂ ਮਨਾਉਂਦੀਆਂ ਸਨ ਅਤੇ ਇੱਕ ਖੁੱਲ੍ਹੇ ਥਾਂ 'ਤੇ ਪੀਂਘਾਂ ਪਾ ਕੇ ਸੋਹਣੇ ਸੋਹਣੇ ਸੂਟ ਘੱਗਰੇ ਫੁਲਕਾਰੀਆਂ ਲੈ ਕੇ ਅਤੇ ਸੱਗੀ ਫੁੱਲ ਲੈ ਕੇ ਸੋਹਣੇ ਸ਼ਿੰਗਾਰ ਕਰਦੀਆਂ ਸਨ ਅਤੇ ਗਿੱਧਾ ਬੋਲੀਆਂ ਪਾਉਂਦੀਆਂ ਸਨ ਪਰ ਹੁਣ ਹੁਣ ਇਨ੍ਹਾਂ ਐਕਸਪੋਜ਼ਰਾਂ ਨੂੰ ਦੇਖ ਕੇ ਲੋਕ ਡੀ ਜੇ 'ਤੇ ਹੀ ਸੌਂਗ ਲਗਾ ਕੇ ਨੱਚਣ ਲੱਗ ਗਏ ਹਨ ਅਤੇ ਆਪਣਾ ਮਨੋਰੰਜਨ ਕਰਦੇ ਹਨ ਕੁੜੀਆਂ ਤੀਆਂ ਵਿੱਚ ਹੀ ਡੀ ਜੇ ਲਗਾ ਕੇ ਬੋਲੀਆਂ ਅਤੇ ਗਿੱਧਾ ਪਾਉਂਦੀਆਂ ਹਨ ਡੀਜਿਆਂ 'ਤੇ ਹੀ ਆਪਣਾ ਮਨੋਰੰਜਨ ਕਰ ਲੈਂਦੇ ਹਨ ਵਿਆਹ ਸ਼ਾਦੀ ਨੂੰ ਉਹ ਪਿਛਲੇ ਉਹਦੇ ਵਿੱਚ ਵਿਆਹ ਸ਼ਾਦੀ ਨੂੰ ਉਹ ਆਪਣੇ ਘਰਾਂ ਵਿੱਚ ਪੰਦਰਾਂ ਦਿਨ ਦਸ ਦਿਨ ਪਹਿਲਾਂ ਹੀ ਨਾਚ ਗ ਗਿੱਧਾ ਗਿੱਧਾ ਬੋਲੀਆਂ ਪਾਉਣੇ ਸ਼ੁਰੂ ਹੋ ਜਾਂਦੇ ਸਨ ਅਤੇ ਉਸ ਤਰ੍ਹਾਂ ਹੀ ਹੁਣ ਅ ਹੁਣ ਇੱਕ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਡੀ ਜੇ ਲਾ ਕੇ ਅਤੇ ਡੀ ਜੇ ਲਾ ਕੇ ਆਪਣਾ ਮਨੋਰੰਜਨ ਕਰ ਲੈਂਦੇ ਹਨ ਉਸ ਤਰ੍ਹਾਂ ਹੀ ਗਿੱਧਾ ਬੋਲੀਆਂ ਪੀਂਘਾਂ ਪਾ ਕੇ ਤੀਆਂ ਲਗਾਉਣੀਆਂ ਚਾਹੀਦੀਆਂ ਹਨ